ਭਾਰਤ ਇੱਕ ਤਿਉਹਾਰਾਂ ਦਾ ਦੇਸ਼ ਹੈ ਇੱਥੇ ਕਈ ਤਰ੍ਹਾਂ ਦੇ ਤਿਉਹਾਰ ਮਨਾਏ ਜਾਂਦੇ ਹਨ ਇਹ ਜ਼ਿਆਦਾਤਰ ਤਿਉਹਾਰ ਧਰਮਾਂ ਦੇ ਪ੍ਰਤੀ ਅਲੱਗ ਅਲੱਗ ਧਰਮਾਂ ਦੇ ਸੰਬੰਧ ਦੇ ਵਿੱਚ ਮਨਾਏ ਜਾਂਦੇ ਹਨ ਜਿਵੇਂ ਕਿ ਭਾਰਤ ਦੇ ਵਿੱਚ ਦੀਵਾਲੀ ਦੁਸਹਿਰਾ ਵਿਸਾਖੀ ਰੱਖੜੀ ਨ ਨਰਾਤੇ ਹੋਰ ਇਸ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਤਿਉਹਾਰ ਮਨਾਏ ਜਾਂਦੇ ਹਨ ਦੀਵਾਲੀ ਜਿਹੜਾ ਤਿਉਹਾਰ ਹੈ ਇਹ ਇੱਕ ਪੂਰੇ ਭਾਰਤ ਦੇ ਵਿੱਚ ਹਰੇਕ ਸਾਲ ਲਗਭਗ ਨਵੰਬਰ ਮਹੀਨੇ ਦੇ ਵਿੱਚ ਜਿਹੜਾ ਦੀਵਾਲੀ ਦਾ ਤਿਉਹਾਰ ਆਉਂਦਾ ਹੈ ਇਹਨੂੰ ਬੜੇ ਜੋਸ਼ ਸ਼ੋਰ ਤਰੀਕੇ ਨਾਲ ਮਨਾਇਆ ਜਾਂਦਾ ਹੈ ਇਹਦੇ ਵਿੱਚ ਭਾਂਤ ਭਾਂਤ ਦੇ ਜੋ ਅਲੱਗ ਅਲੱਗ ਧਰਮਾਂ ਦੇ ਲੋਕ ਹਨ ਇਹਨੂੰ ਇੱਕ ਵੱਖ ਵੱਖ ਤਰੀਕਿਆਂ ਨਾਲ ਮਨਾਉਂਦੇ ਹਨ ਜਿਵੇਂ ਕਿ ਹਿੰਦੂ ਧਰਮ ਦੇ ਵਿੱਚ ਇਸ ਦਿਨ ਇਸ ਰਾਤ ਨੂੰ ਜੋ ਕਿ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਬੱਚਿਆਂ ਵੱਲੋਂ ਪਟਾਕੇ ਵਜਾਏ ਜਾਂਦੇ ਹਨ ਸਿੱਖ ਧਰਮ ਦੇ ਵਿੱਚ ਵੀ ਜੋ ਦੀਵਾਲੀ ਦਾ ਤਿਉਹਾਰ ਉਸ ਦਿਨ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ ਜੋ ਕਿ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਜੋ ਕਿ ਬੰਦੀ ਛੋੜ ਦਿਵਸ ਉਹ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਆਪਣੇ ਨਾਲ ਬਵੰਜਾ ਪਹਾੜੀ ਜੋ ਕਿ ਰਾਜੇ ਉਹਨਾਂ ਨੂੰ ਜੇਲ੍ਹ ਵਿੱਚੋਂ ਛੁਡਾ ਕੇ ਲਿਆਏ ਸਨ ਤਾਂ ਕਿ ਤਾਂ ਕਰਕੇ ਇਸ ਦਿਨ ਨੂੰ ਬੰਦੀ ਛੋੜ ਦਿਵਸ ਕਿਹਾ ਜਾਂਦਾ ਹੈ ਇਸ ਦਿਨ ਸਿੱਖ ਵੀ ਇਹਨਾਂ ਨੂੰ ਬੜੇ ਜ਼ੋਰ ਸ਼ੋਰ ਨਾਲ ਤਰੀਕੇ ਨਾਲ ਮਨਾਉਂਦੇ ਹਨ ਅਤੇ ਬੱਚਿਆਂ ਵੱਲੋਂ ਪਟਾਕੇ ਚਲਾਏ ਜਾਂਦੇ ਹਨ ਆਤਿਸ਼ਬਾਜ਼ੀਆਂ ਚਲਾਈਆਂ ਜਾਂਦੀਆਂ ਹਨ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਗੁਆਂਢੀਆਂ ਨੂੰ ਲੋਕ ਗਿਫਟ ਦਿੰਦੇ ਹਨ ਮਠਿਆਈਆਂ ਦਿੰਦੇ ਹਨ